ਮੋਹਾਲੀ ਜ਼ਿਲ੍ਹੇ ਵਿੱਚ ਮੁਹੱਲਾ ਕਲੀਨਿਕ ਸਰਕਾਰ ਨੇ ਸਥਾਪਿਤ ਕੀਤੇ ਹਨ ਜਿਸ ਨਾਲ ਗਰੀਬਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਅਤੇ ਉਹਨਾਂ ਨੂੰ ਦਵਾਈਆਂ ਟਾਈਮ ਸਿਰ ਮਿਲ ਰਹੀਆਂ ਹਨ